ਸਤਿ ਸ਼੍ਰੀ ਅਕਾਲ ਜੀ ਪੰਜਾਬ ਖੇਤਰ ਦੇ ਲੋਕ ਗੀਤਾਂ ਦੀ ਤੇ ਗੱਲ ਹੀ ਹੋਰ ਐ ਇੱਕ ਪੰਜਾਬਣ ਹੋਣ ਦੇ ਨਾਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਮੈਨੂੰ ਮੇਰੇ ਘਰ ਦਿਆਂ ਨੇ ਬਚਪਨ ਤੋਂ ਹੀ ਪੰਜਾਬ ਦੇ ਲੋਕ ਗੀਤਾਂ ਦੇ ਬਾਰੇ ਬੜਾ ਕੁਝ ਦੱਸਿਆ ਤੇ ਮੈਂ ਛੋਟੇ ਹੁੰਦੇ ਤੋਂ ਹੀ ਆਪਣੇ ਘਰ ਦੇ ਕਈ ਤਿਉਹਾਰਾਂ ਤੇ ਵਿਆਵਾਂ ਤੇ ਇਹਨਾਂ ਦੀ ਚਾਹ ਨਾਲ ਵਰਤੋ ਹੁੰਦੇ ਹੋਏ ਦੇਖੀ ਸਾਡੇ ਕਈ ਲੋਕ ਗੀਤ ਜਿਵੇਂ ਕਿ ਬੋਲੀਆਂ ਜਾਂ ਟੱਪੇ ਸਾਡੇ ਪੰਜਾਬ ਦੇ ਲੋਕ ਨਾਚ ਭੰਗੜੇ ਜਾਂ ਗਿੱਧ ਨਾਲ ਬੜੇ ਚਾਅ ਨਾਲ ਗਾਏ ਜਾਂਦੇ ਹਨ ਤੇ ਲੋਕੀ ਬੜਾ ਹੀ ਆਨੰਦ ਮਾਣਦੇ ਹਨ ਸਾਡੇ ਕਈ ਲੋਕ ਗੀਤ ਬੜੇ ਹੀ ਰੂਹਾਨੀ ਤੇ ਦਰਦ ਭਰੇ ਵੀ ਹਨ ਜਿਨਾਂ ਨਾਲ ਲੋਕੀ ਆਪਣੇ ਮਨ ਦੇ ਭਾਵਾਂ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਪ੍ਰਗਟ ਕਰਦੇ ਹਨ ਸਾਡੇ ਕਈ ਪੁਰਾਣੇ ਲੋਕ ਗੀਤ ਅੱਜ ਕੱਲ ਦੇ ਨਵੇਂ ਜਮਾਨੇ ਦੇ ਗੀਤਾਂ ਵਿੱਚ ਵੀ ਬੜੇ ਚਾਅ ਨਾਲ ਵਰਤੇ ਜਾਂਦੇ ਹਨ ਜਿਵੇਂ ਕੀ ਮਿਰਜ਼ਾ ਸਾਹਿਬਾਂ ਦੀ ਕਹਾਣੀ ਜਾਂ ਹੀਰ ਰਾਂਝਾ ਦੀ ਕਹਾਣੀ ਤੇ ਅਧਾਰਿਤ ਲੋਕ ਗੀਤ ਜੋ ਕੀ ਪੁਰਾਣੇ ਕਵੀ ਤੇ ਲੇਖਕ ਵਾਰਸ਼ ਸ਼ਾਹ ਦੀ ਕਹਾਣੀ ਦੇ ਉੱਤੇ ਅਧਾਰਿਤ ਹਨ ਸਾਡੇ ਕਈ ਲੋਕ ਗੀਤ ਯੁੱਧ ਗੀਤ ਵੀ ਹਨ ਜੋ ਕੀ ਜੰਗ ਤੇ ਜਾ ਰਹੇ ਫੌਜੀਆਂ ਦਾ ਹੌਸਲਾ ਵਧਾਉਂਦੇ ਹਨ